ਜਿੱਦਾਂ ਕਿ ਅਸੀਂ ਯਾਤਰਾ 'ਤੇ ਬਹੁਤ ਵਾਰ ਗਏ ਹਾਂ ਸ਼੍ਰੀ ਹਰਿਮੰਦਰ ਸਹਿਬ ਮੈਂ ਜਦੋਂ ਪਹਿਲੀ ਵਾਰ ਗਿਆ ਸੀ ਤਾਂ ਉੱਥੇ ਇੱਕ ਸਾਨੂੰ ਅਦਬ ਇੱਕ ਨਜ਼ਾਰਾ ਦੇਖਣ ਨੂੰ ਮਿਲਿਆ ਜਿਸ ਤਰ੍ਹਾਂ ਕਿ ਉੱਥੇ ਬਹੁਤ ਸਾਰੇ ਆਪ ਸਭ ਨੂੰ ਪਤਾ ਹੀ ਹੈ ਕਿ ਜਿਹੜਾ ਹਰਿਮੰਦਰ ਸਹਿਬ ਹੈ ਉਹ ਹੈ ਇੱਕ ਸਾਡਾ ਸਰਬ ਸਾਂਝਾ ਤੀਰਥ ਅਸਥਾਨ ਹੈ ਜਿੱਥੇ ਕਿ ਸਾਰੇ ਧਰਮਾਂ ਦੇ ਲੋਕ ਆਉਂਦੇ ਨੇ ਫੋਰਨੀਅਰ ਲੋਕ ਬਹੁਤ ਆਉਂਦੇ ਨੇ ਹਿੰਦੂ ਇਸਾਈ ਮੁਸਲਿਮ ਸਭ ਸਿੱਖ ਸਾਰੇ ਆਉਂਦੇ ਨੇ ਅਤੇ ਮੈਨੂੰ ਉਸ ਸਰਬ ਸਾਂਝੇ ਗੁਰ ਅਸਥਾਨ 'ਤੇ ਜਾ ਕੇ ਮੈਨੂੰ ਬਹੁਤ ਸਾਰਾ ਬੜਾ ਮਤਲਬ ਕੇ ਦੇਖਣ ਨੂੰ ਬੜੀਆ ਬਹੁਤ ਵਧੀਆ ਨਜ਼ਾਰਾ ਮਿਲਿਆ ਉਹਦੇ ਵਿੱਚ ਜਿਸ ਤਰ੍ਹਾਂ ਕਿ ਉੱਥੇ ਸੈਲਾਨੀ ਆਏ ਹੋਏ ਸਨ ਫੋਰਨੀਅਰ ਤੋਂ ਤਾਂ ਉਹ ਫੋਰਨਰ ਜਿਹੜੇ ਸੈਲਾਨੀ ਨੇ ਉਨ੍ਹਾਂ ਨੂੰ ਦੇਖ ਕੇ ਜਿਸ ਤਰ੍ਹਾਂ ਕਿ ਲੰਗਰ ਹਾਲ ਦੇ ਵਿੱਚ ਅਸੀਂ ਜਦੋਂ ਗਏ ਅਤੇ ਮੈਂ ਦੇਖਿਆ ਕਿ ਉਹ ਇੱਕ ਮਤਲਬ ਕਿ ਇੱਕ ਗੋਰਾ ਇੱਕ ਅੰਗਰੇਜ਼ ਅਤੇ ਐਂਡ ਉਸ ਦੀ ਮਿਸਿਜ ਉਹ ਦੋਨੋਂ ਲੰਗਰ ਦੇ ਵਿੱਚ ਸੇਵਾ ਕਰ ਰਹੇ ਸਨ ਉਹ ਦੋਨੋਂ ਲੰਗਰ ਦੇ ਵਿੱਚ ਭਾਂਡਿਆਂ ਦੀ ਸੇਵਾ ਕਰ ਰਹੇ ਸਨ ਜਿਸਨੂੰ ਮੈਨੂੰ ਵੇਖ ਕੇ ਮੇਰੇ ਮਨ ਦੇ ਵਿੱਚ ਇੱਕ ਮਤਲਬ ਕਿ ਬਹੁਤ ਵਧੀਆ ਮੈਸਜ ਗਿਆ ਕਿ ਯਾਰ ਇਹ ਜਿਹੜੇ ਕਿ ਅਸੀਂ ਗੋਰੇ ਅਸੀਂ ਕਹਿੰਦੇ ਹਾਂ ਅੰਗਰੇਜ਼ ਇਹਨਾਂ ਨੂੰ ਕੁਛ ਸਾਡੀ ਸ ਸੰਸਕ੍ਰਿਤੀ ਬਾਰੇ ਸਾਡੇ ਸੱਭਿਆਚਾਰ ਬਾਰੇ ਕੁਛ ਪਤਾ ਨਹੀਂ ਹੈ ਉਹ ਵੀ ਗੁਰ ਅਸਥਾਨਾਂ 'ਤੇ ਆ ਕੇ ਇੱਦਾਂ ਹੱਥੀਂ ਸੇਵਾ ਕਰਦੇ ਨੇ ਅਤੇ ਇਹਦੇ ਵਿੱਚ ਇਹ ਜਦੋਂ ਇਸ ਚੀਜ਼ ਨੂੰ ਮੈਂ ਦੇਖਿਆ ਤਾਂ ਮੇਰੇ ਮਨ ਦੇ ਵਿੱਚ ਇੱਕ ਸੇਵਾ ਭਾਵਨਾ ਪੈਦਾ ਹੋਈ ਅਸੀਂ ਆਖਿਆ ਮੇਰੇ ਮਨ ਦੇ ਵਿੱਚ ਇੱਦਾਂ ਇਹ ਮੈਸਜ ਚਲਿਆ ਗਿਆ ਕਿ ਯਾਰ ਜੇ ਅਗਰ ਇਹ ਅੰਗਰੇਜ਼ ਹੋ ਕੇ ਇਸਾਈ ਧਰਮ ਦੇ ਹੋ ਕੇ ਸ ਇਤਨੀ ਸੇਵਾ ਭਾਵਨਾ ਦੇ ਨਾਲ ਸਾਡੇ ਗੁਰ ਅਸਥਾਨਾਂ ਦੇ ਵਿੱਚ ਸੇਵਾ ਕਰਦੇ ਨੇ ਅਤੇ ਅਸੀਂ ਇੱਕ ਸਿੱਖ ਹੋ ਕੇ ਅਸੀਂ ਪੰਜਾਬੀ ਹੋ ਕੇ ਇੱਥੋਂ ਦੇ ਰਹਿਣ ਵਾਲੇ ਹੋ ਕੇ ਅਸੀਂ ਕਿਓਂ ਨਹੀਂ ਅਸੀਂ ਇੱਦਾਂ ਇੱਦਾਂ ਇੱਦਾਂ ਇੱਦਾਂ ਦੀ ਸੇਵਾ ਭਾਵਨਾ ਨਾਲ ਅਸੀਂ ਸੇਵਾ ਕਰਦੇ ਅਸੀਂ ਖੁਦ ਅਸੀਂ ਇੰਨਾਂ ਸੇਵਾ ਤੋਂ ਦੂਰ ਹਾਂ ਕਿ ਅਸੀਂ ਹੱਥੀਂ ਸੇਵਾ ਕਰਨ ਨੂੰ ਤਿਆਰ ਨਹੀਂ ਪਰੰਤੂ ਉੱਥੋਂ ਦੇ ਜਦੋਂ ਮੈਂ ਸੈਲਾਨੀਆਂ ਨੂੰ ਦੇਖਿਆ ਅਤੇ ਮੇਰੇ ਮਨ ਦੇ ਵਿੱਚ ਬਹੁਤ ਇੱਕ ਸੇਵਾ ਭਾਵਨਾ ਇੱਕ ਪਿਆਰ ਭਾਵਨਾ ਮਿਲੀ ਅਤੇ ਐਂਡ ਮੈਂ ਉੱਥੋਂ ਦੇ ਸੈਲਾਨੀਆਂ ਨਾਲ ਗੱਲ ਬਾਤ ਵੀ ਕੀਤੀ ਮੈਨੂੰ ਬਹੁਤ ਅੱਛਾ ਲੱਗਿਆ ਮੈਂ ਉਹਨਾਂ ਤੋਂ ਬਹੁਤ ਪ੍ਰਭਾਵਿਤ ਹੋਇਆ ਉੱਥੋਂ ਦੇ ਲੋਕਾਂ ਦਾ ਲਹਿਜ਼ਾ ਬੋਲਣ ਦਾ ਤਰੀਕਾ ਐਂਡ ਸਲੀਕਾ ਬਹੁਤ ਵਧੀਆ ਉਹਨਾਂ ਦਾ ਅਤੇ ਬੜੇ ਪਿਆਰ ਨਾਲ ਭਰੇ ਹੋਏ ਨੇ ਰੱਜੀਆਂ ਰੂਹਾਂ ਨੇ ਉਹ ਲੋਕ ਜੋ ਉੱਥੇ ਸੈਲਾਨੀ ਆਏ ਨੇ ਅਤੇ ਗੁਰੂ ਸਾਹਿਬਾਨ ਨੂੰ ਨਸਤਮਸਤਕ ਹੁੰਦੇ ਨੇ ਅਤੇ ਅਸੀਂ ਵੀ ਨਸਮਸਤਕ ਹੋਏ ਗੁਰੂ ਸਾਹਿਬ ਨੂੰ ਅਤੇ ਸਾਨੂੰ ਬੜਾ ਅੱਛਾ ਲੱਗਿਆ ਅਤੇ ਉਹਨਾਂ ਸੈਲਾਨੀਆਂ ਦਾ ਪ੍ਰਭਾਵ ਮੈਂ ਕਦੇ ਵੀ ਜ਼ਿੰਦਗੀ ਦੇ ਵਿੱਚ ਭੁੱਲਦਾ ਨਹੀਂ ਉਹਨਾਂ ਸੈਲਾਨੀਆਂ ਦੇ ਸਥਾਈ ਪ੍ਰਭਾਵ ਕਰਕੇ ਮੈਂ ਅੱਜ ਜਦੋਂ ਵੀ ਕਿਤੇ ਗੁਰੂ ਘਰ ਗੁਰ ਅਸਥਾਨ 'ਤੇ ਜਾਂਦਾ ਹਾਂ ਤਾਂ ਮੈਂ ਖੁਦ ਵੀ ਹੱਥੀਂ ਸੇਵਾ ਕਰਨ ਦਾ ਇੱਛੁਕ ਹੁੰਦਾ ਹਾਂ ਅਤੇ ਮੈਨੂੰ ਜੋ ਵੀ ਹੱਥੀਂ ਸੇਵਾ ਕਰਨ ਨੂੰ ਮਿਲਦੀ ਹੈ ਤਾਂ ਮੈਂ ਕਰਦਾ ਹਾਂ ਮੈਨੂੰ ਸੋ ਬਹੁਤ ਅੱਛਾ ਲੱਗਿਆ ਸੋ ਇਸ ਤਰ੍ਹਾਂ ਦੇ ਸੈਲਾਨੀਆਂ ਤੋਂ ਸਾਨੂੰ ਪ੍ਰਭਾਵਿਤ ਹੋਣਾ ਚਾਹੀਦਾ ਹੈ ਐਂਡ ਮੈਂ ਤਾਂ ਸ਼ੁਕਰ ਗੁਜ਼ਾਰ ਹਾਂ ਕਿ ਮੈਨੂੰ ਇੱਦਾਂ ਦੇ ਸੈਲਾਨੀ ਮਿਲੇ ਕਿ ਜਿਹਨਾਂ ਤੋਂ ਮੈਂ ਪ੍ਰਭਾਵਿਤ ਹੋਇਆ